ਇੱਕ ਸੌ ਪਚਾਸੀ ਬਾਰ੍ਹਾਂ ਹਜ਼ਾਰ ਸੱਤ ਸੌ ਅੱਸੀ ਪੰਜਾਹ ਹਜ਼ਾਰ ਅੱਠ ਸੌ ਨੱਬੇ ਚਾਰ ਲੱਖ ਦਸ ਹਜ਼ਾਰ ਪੰਜ ਸੌ ਨੌ ਲੱਖ ਪਝੱਤਰ ਹਜ਼ਾਰ ਚਾਰ ਸੌ ਪੰਜਾਹ